ਮੇਰੇ ਕੋਲ ਭੋਜਨ ਬਣਾਉਣ ਨਾਲ ਸੰਬੰਧਿਤ ਪਰੰਪਰਾਵਾਂ ਹਨ ਪਰੰਪਰਾਵਾਂ ਤਾਂ ਜ਼ਰੂਰ ਹਨ ਪਰ ਅੰਧ ਵਿਸ਼ਵਾਸ ਕੋਈ ਨਹੀਂ ਹੈ ਕਿਉਂਕਿ ਮੈਂ ਇੱਕ ਸਿੱਖ ਹਾਂ ਮੈਂ ਕਿਸੇ ਵੀ ਅੰਧ ਵਿਸ਼ਵਾਸ 'ਤੇ ਕੋਈ ਵਿਸ਼ਵਾਸ ਨਹੀਂ ਕਰਦੀ ਗੁਰਬਾਣੀ 'ਤੇ ਵਿਸ਼ਵਾਸ ਆ ਜਿਸ ਤਰ੍ਹਾਂ ਭੋਜਨ ਬਣਾਉਣ ਸਮੇਂ ਤੁਸੀਂ ਪਹਿਲੀ ਗੱਲ ਸਭ ਤੋਂ ਪਹਿਲਾਂ ਸੁੱਚਮ ਦੀ ਹੈ ਜੀ ਆਪਣੇ ਹੱਥ ਸੁੱਚੇ ਕਰੋ ਚੰਗੀ ਤਰ੍ਹਾਂ ਧੋਵੋ ਫਿਰ ਕੋਈ ਚੀਜ਼ ਬਣਾਉਣੀ ਸ਼ੁਰੂ ਕਰੋ ਹੈ ਨਾ ਅਤੇ ਭੋਜਨ ਬਣਾਉਂਦੇ ਸਮੇਂ ਜਿਵੇਂ ਜਿਹੜੇ ਤੁਹਾਡੇ ਖਿਆਲ ਨੇ ਉਹ ਭੋਜਨ 'ਤੇ ਬਹੁਤ ਅਸਰ ਕਰਦੇ ਨੇ ਅਤੇ ਭੋਜਨ ਬਣਾਉਂਦੇ ਸਮੇਂ ਤੁਸੀਂ ਚੰਗੇ ਸ਼ਬਦ ਗੁਣ ਗੁਣਾਵੋ ਗੁਰਬਾਣੀ ਦੀਆਂ ਪੰਕਤੀਆਂ ਗਾਓ ਆਪਣੇ ਗੁਰੂ ਪੀਰ ਨੂੰ ਯਾਦ ਕਰਦੇ ਹੋਏ ਭੋਜਨ ਤਿਆਰ ਕਰੋ ਅਤੇ ਉਸੇ ਤਰ੍ਹਾਂ ਦਾ ਜਿਹੜਾ ਅਸਰ ਹੈ ਉਹ ਭੋਜਨ 'ਤੇ ਹੁੰਦਾ ਅਤੇ ਫਿਰ ਉਹ ਜਿਹੜਾ ਭੋਜਨ ਪੱਕਿਆ ਜਦੋਂ ਉਹ ਜਿਸ ਕਿਸੇ ਵਿਅਕਤੀ ਨੇ ਖਾਣਾ ਉਹ ਖਾਣ ਵਾਲੇ 'ਤੇ ਵੀ ਉਹ ਹੀ ਅਸਰ ਹੁੰਦਾ ਹੈ ਜੀ ਅਤੇ ਇਸੇ ਤਰ੍ਹਾਂ ਹੀ ਜਦੋਂ ਭੋਜਨ ਬਣ ਗਿਆ ਖਾਣ ਸਮੇਂ ਵੀ ਅਸੀਂ ਵੀ ਹੱਥ ਚੰਗੀ ਤਰ੍ਹਾਂ ਧੋਵੋ ਖਾਣਾ ਸ਼ੁਰੂ ਕਰੋ ਅਤੇ ਖਾਂਦੇ ਸਮੇਂ ਸ ਅਸੀਂ ਕੋਈ ਸਾਨੂੰ ਨਾ ਅਸੀਂ ਫ਼ੋਨ ਦੇਖਣਾ ਨਾ ਅਸੀਂ ਟੀ ਵੀ ਦੇਖਣਾ ਜੀ ਨਾ ਹੀ ਕੋਈ ਬਹੁਤੀਆਂ ਗੱਲਾਂ ਕਰਨੀਆਂ ਨੇ ਅਤੇ ਇਸ ਤਰ੍ਹਾਂ ਖਾਂਦੇ ਸਮੇਂ ਵੀ ਤੁਹਾਨੂੰ ਸਾਨੂੰ ਥੋੜ੍ਹੀ ਜਿਹੀ ਇਤਿਹਾਤ ਉਹ ਵਰਤਣੀ ਚਾਹੀਦੀ ਇਸ ਤਰ੍ਹਾਂ ਦੀਆਂ ਪਰੰਪਰਾਵਾਂ ਨੇਗੀਆਂ ਸਿੰਪਲ ਕੋਈ ਅੰਧ ਵਿਸ਼ਵਾਸ ਨਹੀਂ ਹੈ